ਟੀਚਿੰਗ ਦੇ ਵਿੱਚ ਟੈਕਨੋਲੋਜੀ ਨੇ ਇੱਕ ਬਹੁਤ ਹੀ ਵੱਡਾ ਬਦਲਾਅ ਲੈ ਕੇ ਆਉਂਦਾ ਹੈ ਇਕ ਟੀਚਰ ਜਿਸਨੂੰ ਪਹਿਲਾਂ ਕੋਈ ਵੀ ਚੀਜ਼ ਐਕਸਪਲੇਨ ਕਰਨ ਦੇ ਲਈ ਕੋਈ ਵੀ ਡਾਇਗਰਾਮ ਐਕਸਪਲੇਨ ਕਰਨ ਦੇ ਲਈ ਪਹਿਲਾਂ ਡ ਬਲੈਕ ਬੋਰਡ ਜਾਂ ਵਾਈਟ ਬੋਰਡ ਦੇ ਉੱਤੇ ਜਿਹੜਾ ਹੈਗਾ ਡਰਾਅ ਕਰਨੀ ਪੈਂਦੀ ਸੀ ਉਹਦੇ ਨਾਲ ਕਾਫ਼ੀ ਟਾਈਮ ਜਿਹੜਾ ਹੈਗਾ ਨਿਕਲ ਜਾਂਦਾ ਸੀਗਾ ਹੁਣ ਕੀ ਹੈ ਇਹ ਪ੍ਰੋਜੈਕਟਰ ਦੀ ਮਦਦ ਦੇ ਨਾਲ ਹਾਂ ਇਮੇਜ ਜਿਹੜੀ ਹੈਗੀ ਆ ਸਿੱਧੀ ਸਾਹਮਣੇ ਸਕਰੀਨ ਦੇ ਉੱਤੇ ਡਿਸਪਲੇਅ ਹੋ ਜਾਂਦੀ ਹੈਗੀ ਆ ਉਹਦੇ ਨਾਲ ਟਾਈਮ ਸੇਵ ਹੁੰਦਾ ਔਰ ਉਹਨੂੰ ਐਕਸਪਲੇਨ ਕਰਨ ਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਹੀ ਵਧੀਆ ਤਰੀਕੇ ਨਾਲ ਸਟੂਡੈਂਟਸ ਨੂੰ ਸਮਝਾਇਆ ਜਾ ਸਕਦਾ ਹੈ ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਹੈਗੇ ਨੇ ਟੀਚਰ ਨੂੰ ਸਟੂਡੈਂਟਸ ਦਾ ਰਿਕਾਰਡ ਮੇਨਟੇਨ ਕਰਨ ਦੇ ਲਈ ਜਿਹੜਾ ਹੈਗੇ ਆ ਹਰ ਵੇਲੇ ਇੱਕ ਰਜਿਸਟਰ ਮੇਨਟੇਨ ਕਰਨਾ ਪੈਂਦਾ ਸੀਗਾ ਉਹਨਾਂ ਦੀ ਜਿਹੜੀ ਵੀ ਅਟੈਂਡੈਂਸ ਹੈ ਹਾਜ਼ਰੀ ਹੈਗੀ ਹੈ ਜਾਂ ਉਹਨਾਂ ਦੀ ਛੁੱਟੀਆਂ ਦੇ ਜਿਹੜੇ ਡਿਟੇਲ ਹੈਗੀ ਹੈ ਉਹ ਅਲੱਗ ਅਲੱਗ ਪੇਪਰਜ ਦੇ ਉੱਤੇ ਮੈਨਟੇਨ ਕਰਨੀ ਪੈਂਦੀ ਸੀਗੀ ਅਤੇ ਉਹਦੇ ਨਾਲ ਕੀ ਹੈਗਾ ਪੇ ਟਾਈਮ ਅਤੇ ਪੇਪਰ ਦੀ ਵੇਸਟੇਜ ਬਹੁਤ ਜ਼ਿਆਦਾ ਹੁੰਦੀ ਸੀ ਹੁਣ ਉਹਦੇ ਨਾਲ ਕੀ ਹੈਗਾ ਸੋਫਟਵੇਅਰ ਇੱਕ ਮੈਨੇਜਮੈਂਟ ਸੋਫਟਵੇਅਰ ਹੈਗਾ ਉਹਦੇ ਵਿੱਚ ਤੁਸੀਂ ਰਜਿਸਟਰ ਮੇਨਟੇਨ ਨਹੀਂ ਕਰਨਾ ਸਿ ਡਾਇਰੈਕਟਲੀ ਤੁਹਾਡੇ ਕੋਲ ਸਟੂਡੈਂਟ ਦੀ ਲਿਸਟ ਹੈਗੀ ਹੈ ਕੌਣ ਪ੍ਰੈਜੈਂਟ ਆ ਉਹਦੀ ਅਟੈਨਡੈਂਸ ਮਾਰਕ ਕਰਨੀ ਹੈਗੀ ਹੈ ਐਬਸੈਂਟ ਦੀ ਡੀਟੇਲਸ ਮਾਰਕ ਕਰਨੀਆਂ ਨੇ ਜੋ ਬੱਚਿਆਂ ਸਟੂਡੈਂਟਸ ਜਿਹੜੇ ਹੈਗੇ ਨੇ ਜੋ ਬੱਚੇ ਹੈਗੇ ਨੇ ਉਹਨਾਂ ਦੇ ਜਿੰਨੇ ਨੰਬਰ ਆਏ ਹੈਗੇ ਨੇ ਉਹ ਸਿੰਗਲ ਸ਼ੀਟ ਦੇ ਵਿੱਚ ਐਂਟਰੀ ਹੋ ਜਾਂਦੀ ਹੈਗੀ ਆ ਹੁਣ ਪਹਿਲਾਂ ਇਹ ਸਾਰਾ ਡਾਟਾ ਪੇਰੈਂਟਸ ਨੂੰ ਹਰ ਮਹੀਨੇ ਸ਼ੇਅਰ ਕਰਨ ਦੇ ਲਈ ਪਹਿਲਾਂ ਪੇ ਇੱਕ ਪੇਪਰ ਦੇ ਉੱਤੇ ਨੋਟ ਕਰਨਾ ਪੈਂਦਾ ਸੀ ਪੋਸਟ ਕਰਨਾ ਪੈਂਦਾ ਸੀ ਇਸ ਮੈਨੇਜਮੈਂਟ ਸਿਸਟਮ ਦੇ ਥਰੂ ਕੀ ਹੈਗਾ ਆ ਇਹ ਡਾਇਰੈਕਟਲੀ ਅਸੀਂ ਥਰੂ ਮੇਲ ਪੇਰੈਂਟਸ ਨੂੰ ਇਮੀਜੇਟਲੀ ਪਹੁੰਚਦਾ ਕਰ ਲੈਂਦੇ ਹੈਗੇ ਹਾਂ ਧੰਨਵਾਦ